ਮੇਰਾ ਆਪਣੇ ਕੱਪੜੇ ਦਾ ਕੰਮ ਹੈ ਬਹੁਤ ਵਧੀਆ ਕੰਮ ਹੈ ਜੀ ਮੇਰਾ ਮੈਂ ਕੱਪੜਾ ਲੁਧਿਆਣੇ ਤੋਂ ਮਾਲ ਲਿਆਂਦਾ ਵੀਰ ਜੀ ਵ ਬਹੁਤ ਵਧੀਆ ਮਾਲ ਸੀਗਾ ਅਤੇ ਵੈਸੇ ਇੰਨਾ ਪਸੰਦ ਨਹੀਂ ਸੀਗਾ ਅੱਜ ਮੈਂ ਅੱਜ ਅੰਬਰਸਰ ਵੀ ਗਈ ਅੰਬਰਸਰੋ ਵੀ ਵਧੀਆ ਨਹੀਂ ਮਿਲੇ ਫੇਰ ਮੈਂ ਨਾ ਇੱਕ ਬਾਬੇ ਦੀ ਹੱਟੀ ਆ ਲੁਧਿਆਣੇ 'ਚ ਹੀ ਅਤੇ ਇੱਕ ਉੱਥੇ ਗਈ ਅਤੇ ਉੱਥੋਂ ਵੀ ਵਧੀਆ ਸੂਟ ਮਿਲੇ ਕੋਟਨ ਦੇ ਪਿਓਰ ਦੁਪੱਟੇ ਵਾਲੇ ਸੂਟ ਲੋਕਾਂ ਨੇ ਬਹੁਤ ਪਸੰਦ ਕਰੇ ਅਤੇ ਲੋਕਾਂ ਨੇ ਬਹੁਤ ਕਿਹਾ ਕਿ ਇਹ ਕੱਪੜਾ ਦਵਿੰਦਰ ਤੇਰਾ ਬਹੁਤ ਵਧੀਆ ਹੈ ਕਿ ਇਵੇਂ ਦਾ ਹੀ ਕੱਪੜਾ ਲਈਂ ਫੇਰ ਮੈਂ ਸੋਚਿਆ ਕਿਤੋਂ ਹੋਰ ਟਰਾਈ ਕਰਾਂ ਫੇਰ ਮੈਂ ਜਲੰਧਰ ਗਈ ਜਲੰਧਰ ਬਾਬੇ ਦੀ ਹੱਟੀ ਆ ਉਥੋਂ ਨਾ ਬਹੁਤ ਵਧੀਆ ਕੱਪੜਾ ਮਿਲਦਾ ਅਤੇ ਉਸਨੇ ਅੱਛਾ ਗਾਈਡ ਕਰਿਆ ਕਿ ਹਾਂ ਬਈ ਇਹ ਕੱਪੜਾ ਲੈ ਕੇ ਜਾਉ ਤੁਸੀਂ ਅੱਜ ਕੱਲ੍ਹ ਇਹ ਲੁੱਕ ਚਲਦੀ ਕਿਹਾ ਗਰਲਿਸ਼ ਲੁੱਕ ਹੈ ਕਿ ਤੁਹਾਡਾ ਬਹੁਤ ਵਿਕੇਗਾ ਬਹੁਤ ਵਧੀਆ ਜਾਊਗਾ ਲੇਕਿਨ ਜਦੋਂ ਮੈਂ ਉਹ ਕੱਪੜਾ ਲੈ ਕੇ ਆਈ ਆਪਣਾ ਦੁਕਾਨ 'ਚ ਕੱਪੜਾ ਜਿਵੇਂ ਲੋਕ ਕਹਿਣ ਬਹੁ ਬਹੁਤ ਵਧੀਆ ਕੱਪੜਾ ਹੈ ਕਲਰ ਵਗੈਰਾ ਅੱਛੇ ਸੀਗੇ ਡਜ਼ਾਇਨ ਅੱਛਾ ਸੀਗਾ ਨਵੀਂ ਲੁੱਕ ਸੀਗੀ ਅਤੇ ਨਵੇਂ ਡਜ਼ਾਇਨਾਂ ਦੇ ਸੂਟ ਸੀਗੇ ਜਿਵੇਂ ਪਲੇਜੋ ਸੂਟ ਹੋ ਗਿਆ ਠੀਕ ਹੈ ਘੱਗਰਾ ਲਹਿੰਗਾ ਸੂਟ ਹੋ ਗਿਆ ਇਹ ਬਹੁਤ ਰੇਟ ਵਗੈਰਾ ਮੈਨੂੰ ਸਹੀ ਰੇਟ ਮਿਲੇ ਅਤੇ ਜਦੋਂ ਮੈਂ ਉਸ ਸਹੀ ਰੇਟ ਦਿੱਤੇ ਲੋਕਾਂ ਨੇ ਮੇਰਾ ਦੇਖਿਆ ਅਤੇ ਲੋਕ ਕਹਿੰਦੇ ਦਵਿੰਦਰ ਕੱਪੜਾ ਤੇਰੇ ਤੋਂ ਹੀ ਲੈਣਾ ਕਿ ਮੇਰਾ ਕੱਪੜਾ ਦੀ ਐਨੇ ਜ਼ਿਆਦਾ ਨਾ ਰੇਟ ਵੀ ਸਹੀ ਸੀਗੇ ਰੇਟ ਵੀ ਕੋਈ ਜ਼ਿਆਦਾ ਨਹੀਂ ਮਾਰਕਿਟ ਨਾਲੋਂ ਮੈਂ ਦਸ ਪ੍ਰਸੈਂਟ ਲੈਸ ਕਰਕੇ ਦਿੱਤੇ ਕਿ ਜੇ ਪੰਜਾਹ ਰੁਪਈਏ ਬਚ ਗਏ ਆਪਾਂ ਨੂੰ ਉਹ ਵੀ ਫਾਇਦਾ ਹੈ ਕਿ ਆਪਣਾ ਬਿਜ਼ਨਸ ਚੱਲਣਾ ਚਾਹੀਦਾ ਕਿ ਮੇਰਾ ਬਿਜ਼ਨਸ ਇੰਨਾ ਅੱਛਾ ਚੱਲਿਆ ਕਿ ਬਹੁਤ ਵਧੀਆ ਰਿਸਪਾਂਸ ਮਿਲਿਆ ਮੈਨੂੰ ਉਸ ਬਿਜ਼ਨਸ ਦਾ